ਸਾਡੇ ਆਲੇ ਦੁਆਲੇ ਕਈ ਸਾਰੇ ਖੇਡ ਕੇਂਦਰ ਹਨ ਜਿਹੜੀਆਂ ਬਹੁਤ ਹੀ ਚੰਗੀਆਂ ਹਨ ਅਤੇ ਬੱਚੇ ਵੀ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ ਕਈ ਸਾਰੇ ਖੇਡ ਕੇਂਦਰਾਂ ਵਿੱਚੋਂ ਮੁੱਖ ਖੇਡ ਕੇਂਦਰ ਹੈ ਫੁੱਟਬੋਲ ਖੇਡ ਕੇਂਦਰ ਅਤੇ ਕ੍ਰਿਕੇਟ ਖੇਡ ਕੇਂਦਰ ਫੁੱਟਬਾਲ ਖੇਤ ਖੇਡ ਕੇਂਦਰ ਬੱਚੇ ਹਮੇਸ਼ਾ ਹੀ ਸ਼ਾਮ ਨੂੰ ਜਾਂਦੇ ਹਨ ਕਿਉਂਕਿ ਉਹ ਉਸ ਵੇਲੇ ਹੀ ਉਪਲੱਬਧ ਰਹਿੰਦੇ ਹਨ ਉੱਥੇ ਕਈ ਸਾਰੇ ਬੱਚੇ ਇਕੱਠੇ ਖੇਡ ਦੇ ਹਨ ਅਤੇ ਉਨ੍ਹਾਂ ਨੂੰ ਸਿਖਾਉਣ ਲਈ ਅਧਿਆਪਕ ਵੀ ਹਨ ਜਿਹੜੀਆਂ ਉਨ੍ਹਾਂ ਦੀ ਦੀਆਂ ਮਦਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਕਮੀਆਂ ਦੂਰ ਕਰਦੇ ਹਨ ਉਹ ਉਨ੍ਹਾਂ ਨੂੰ ਉਸ ਖੇਡ ਦੇ ਨਿਯਮ ਬਾਰੇ ਵੀ ਦੱਸਦੇ ਹਨ ਅਤੇ ਕਿਤੇ ਨਾ ਕਿਤੇ ਉਨ੍ਹਾਂ ਦੀਆਂ ਮਾਨਸਿਕ ਅਤੇ ਸਰੀਰਿਕ ਸ਼ਕਤੀ ਵੀ ਵਧਾਉਂਦੇ ਹਨ ਦੂਜਾ ਮੁੱਖ ਖੇਡ ਕੇਂਦਰ ਹੈ ਕ੍ਰਿਕੇਟ ਖੇਡ ਕੇਂਦਰ ਇਹ ਸਵੇਰ ਵੇਲੇ ਉਪਲੱਬਧ ਰਹਿੰਦਾ ਹੈ ਅਤੇ ਇੱਥੇ ਤਾਂ ਭੀੜ ਬਹੁਤ ਸਾਰੀ ਰਹਿੰਦੀ ਹੈ ਕਿਉਂਕਿ ਬੱਚੇ ਕ੍ਰਿਕੇਟ ਨੂੰ ਬਹੁਤ ਪਸੰਦ ਕਰਦੇ ਹਨ ਇੱਥੇ ਕਈ ਸਾਰੇ ਅਧਿਆਪਕ ਵੀ ਰਹਿੰਦੇ ਹਨ ਜਿਹੜੇ ਉਨ੍ਹਾਂ ਨੂੰ ਦੱਸਦੇ ਹਨ ਕਿ ਕੀ ਸਹੀ ਹੈ ਅਤੇ ਕੀ ਗਲਤ ਕ੍ਰਿਕਟ ਦੇ ਕੀ ਨਿਯਮ ਨੇ ਅਤੇ ਸਾਨੂੰ ਕਿਵੇਂ ਇੱਕ ਚੰਗਾ ਖਿਡਾਰੀ ਬਣਨਾ ਹੈ ਅਤੇ ਕਿਸ ਤਰ੍ਹਾਂ ਅਸੀਂ ਇਸ ਖੇਡ ਵਿੱਚ ਆਪਣੇ ਦੇਸ਼ ਨੂੰ ਮੈਡਲ ਦਵਾ ਸਕਦੇ ਹਨ ਅਤੇ ਪੂਰੀ ਦੁਨੀਆਂ ਵਿੱਚ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ